ਮੈਂ ਰਾਜਕੁਮਾਰ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਇੱਕ ਸਕੂਲ ਬੱਸ ਦਾ ਡਰਾਈਵਰ ਹਾਂ ਕੱਲ੍ਹ ਮੈਂ ਜਦੋਂ ਸਕੂਲ ਤੋਂ ਛੁੱਟੀ ਕਰਕੇ ਵਾਪਸ ਆ ਰਿਹਾ ਤਾਂ ਰੋਡ ਦੇ ਉੱਪਰ ਮੈਂ ਵੇ ਕੀ ਵੇਖਦਾ ਹਾਂ ਇੱਕ ਬੱਸ ਅਤੇ ਕਾਰ ਦਾ ਆਪਸ ਵਿੱਚ ਟਕਰਾਈਆਂ ਹੋਈਆਂ ਸਨ ਜਿਸ ਵਿੱਚ ਬੱਸ ਵਿੱਚ ਕਾਫੀ ਸਵਾਰੀਆਂ ਅਤੇ ਕਾਰ ਵਿੱਚ ਵੀ ਦੋ ਚਾਰ ਜਣੇ ਬੈਠੇ ਸਨ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ ਅਤੇ ਮੈਂ ਸਰ ਤੁਹਾਨੂੰ ਫੋਨ ਕਰ ਰਿਹਾ ਹਾਂ ਕਿ ਤੁਸੀਂ ਜਲਦੀ ਜਲਦੀ ਇੱਥੇ ਵੱਧ ਤੋਂ ਵੱਧ ਮਤਲਬ ਵੀ ਲੋਕ ਖੜ੍ਹੇ ਹਨ ਅਤੇ ਐਬੂਲੈਂਸ ਘੱਟੋ ਘੱਟ ਦੋ ਐਬੂਲੈਂਸ ਇੱਥੇ ਪਹੁੰਚਾਓ ਮੈਂ ਡਿਫੈਂਸ ਰੋਡ 'ਤੇ ਖੜ੍ਹਾ ਹਾਂ ਅਤੇ ਇਸ ਵਿੱਚ ਮੈਂ ਵੇਖਿਆ ਕਿ ਚਲੋ ਉੱਤਰ ਕੇ ਇਹਨਾਂ ਦੀ ਮਦਦ ਕਰਦਾ ਹਾਂ ਮੈਂ ਕਾਫੀ ਬੰਦਿਆਂ ਨੂੰ ਥੋੜ੍ਹਾ ਗੱਡੀ 'ਚੋਂ ਬਾਹਰ ਕੱਢ ਕੇ ਉਹਨਾਂ ਨੂੰ ਪਾਣੀ ਵਾਣੀ ਪਿਲਾ ਕੇ ਥੋੜ੍ਹਾ ਸਾਈਡ 'ਤੇ ਬਿਠਾਇਆ ਹੈ ਜਿਸ ਵਿੱਚ ਕਾਫੀ ਬੰਦੇ ਤਾਂ ਗੰਭੀਰ ਹਾਲਤ ਵਿੱਚ ਹਨ ਮੈਂ ਚਾਹੁੰਦਾ ਹਾਂ ਕਿ ਇਹ ਸਮੇਂ ਸਿਰ ਹੋਸਪੀਟਲ ਵਿੱਚ ਪਹੁੰਚ ਜਾਣ ਅਤੇ ਇਹਨਾਂ ਦਾ ਇਲਾਜ ਸ਼ੁਰੂ ਕੀਤਾ ਜਾਵੇ ਤਾਂ ਕਿ ਇਹ ਬੱਚੇ ਵੀ ਆਪਣੇ ਠੀਕ ਠਾਕ ਹੋ ਕੇ ਘਰਾਂ ਨੂੰ ਚਲੇ ਜਾਣ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਲਦੀ ਜਲਦੀ ਇੱਥੇ ਪਹੁੰਚਣ ਦੀ ਕਿਰਪਾ ਕਰੋ